ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਵੈਸੇ ਤਾਂ ਮੇਰੀ ਕੋਈ ਆਮ ਮਨ ਪਸੰਦ ਮੈਮਰੀ ਅਤੇ ਸਟਾਰ ਗਜਿੰਗ ਮੈਂਮਰੀ ਤਾਂ ਹੈ ਨਹੀਂ ਬਟ ਇੱਕ ਹੈ ਕਿ ਮੈਂ ਆਪਣੇ ਜੀਵਨ ਵਿੱਚ ਜਦੋਂ ਪਹਿਲੀ ਵਾਰੀ ਏ ਆਈ ਦਾ ਨਾਂ ਸੁਣਿਆ ਜੋ ਕਿ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ ਅਤੇ ਇੱਕ ਮੈਂ ਆਪਣੀ ਅੱਖੀਂ ਇੱਕ ਰਬੋਟ ਵੇਖਿਆ ਸੀ ਜੋ ਕਿ ਆਪਣਾ ਹਰ ਇੱਕ ਕੰਮ ਕਰ ਸਕਦਾ ਸੀ ਉਹ ਜਦੋਂ ਮੈ ਉਹਨੂੰ ਆਪਣੀ ਅੱਖੀਂ ਵੇਖਿਆ ਉਹ ਮੇਰੀ ਸਟਾਰ ਗਜਿੰਗ ਮੈਂਮਰੀ ਸੀ ਮੈਂ ਉਹਨੂੰ ਵੇਖ ਕੇ ਇਕਦਮ ਚੋਂਕ ਗਿਆ ਕਿ ਇੱਕ ਇਨਸਾਨ ਜੋ ਨਹੀਂ ਹੈ ਇਨਸਾਨ ਨੇ ਜਿਹਨੂੰ ਬਣਾਇਆ ਹੈ ਉਹ ਹਰ ਕੰਮ ਕਰ ਸਕਦਾ ਹੈ ਜੋ ਇਨਸਾਨ ਕਰ ਸਕਦਾ ਹੈ ਉਹ ਦੂਜੇ ਬਾਰੇ ਪਤਾ ਕਰ ਸਕਦਾ ਹੈ ਕਿ ਕੌਣ ਕਿੱਥੇ ਹੈ ਐਸਾ ਉਹਦੇ ਵਿੱਚ ਜੰਤਰ ਰੱਖਿਆ ਹੋਇਆ ਹੈ ਜੋ ਕਿ ਕੁਛ ਵੀ ਕਰ ਸਕਦਾ ਹੈ ਅਤੇ ਮੈਂ ਇਹ ਵੇ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਹੈ ਇੱਕ ਇਨਸਾਨ ਇੱਦਾਂ ਦੀ ਚੀਜ਼ ਬਣਾ ਸਕਦਾ ਹੈ ਜੋ ਕਿ ਦੂਜੇ ਵੇਖ ਕੇ ਹੈਰਾਨ ਹੋ ਜਾਣ ਕਿ ਇੱਕ ਨਾ ਜੋ ਇਨਸਾਨ ਆ ਜੋ ਇਨਸਾਨ ਨਹੀਂ ਆ ਉਹ ਹਰ ਕੰਮ ਕਰੇਗਾ ਕੋਈ ਕੋਈ ਤੁਹਾਡੇ ਕੱਪੜੇ ਧੋਏਗਾ ਤੁਹਾਡੇ ਲਈ ਖਾਣਾ ਬਣਾਏਗਾ ਤੁਹਾਡੇ ਲਈ ਕਸਰਤ ਕਰੇਗਾ ਤੁਹਾਨੂੰ ਕਸਰਤ ਕਰਾਏਗਾ ਤੁਹਾਡੇ ਧਿਆਨ ਰੱਖੇਗਾ ਤੁਹਾਡਾ ਤੁਹਾਨੂੰ ਹਰ ਕੰਮ ਕਰਕੇ ਦਵੇਗਾ ਇਸ ਤਰਾਂ ਕਿੱਦਾਂ ਹੋ ਸਕਦਾ ਹੈ ਅਤੇ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਵੇਖਿਆ ਉਹਦਾ ਸਟਕਚਰ ਉਹਦਾ ਬਣਾਵਟ ਵੇਖੀ ਅਤੇ ਮੈਂ ਬਹੁਤ ਹੈਰਾਨ ਹੋਇਆ ਇੱਕਦਮ ਮੇਰੇ ਲਈ ਇਹ ਬਹੁਤ ਮੇਰੇ ਮਨ ਵਿੱਚ ਵੱਸ ਗਿਆ ਇਹ ਮੇਰੀ ਮਨ ਪਸੰਦ ਮੈਮਰੀ ਸੀ ਜਿਸ ਨੂੰ ਕਿ ਅਸੀਂ ਸਟਾਰ ਗਜਿੰਗ ਮੈਂਮਰੀ ਕਹਿ ਸਕਦੇ ਹਾਂ ਬਹੁਤ ਵਧੀਆ ਲੱਗਾ ਮੈਨੂੰ ਇਹ ਦੇਖ ਕੇ ਕਿਸੇ ਵੇਖ ਕੇ ਕਿ ਇੱਦਾਂ ਹੋ ਸਕਦਾ ਹੈ ਕਿ ਕੋਈ ਇੱਦਾਂ ਬਣਾ ਸਕਦਾ ਹੈ ਅਤੇ ਜਿੱਦਾਂ ਕਿ ਤੁਸੀਂ ਜਾਣਦੇ ਕਿ ਸਾਡੇ ਭਵਿੱਖ ਵਿੱਚ ਹੋਰ ਇਸ ਤਰ੍ਹਾਂ ਦੇ ਕਈ ਬਣਾਵਟੀ ਐਸੇ ਇਨਸਾਨ ਵਾਂਗੂ ਜੋ ਚਲ ਸਕਣ ਐਸੇ ਰਬੋਟ ਆ ਸਕਦੇ ਹਨ ਜੋ ਕਿ ਸਾਡੇ ਜੀਵਨ ਵਿੱਚ ਬਹੁਤ ਵੱਡੇ ਪੱਧਰ 'ਤੇ ਤਰੱਕੀ ਕਰਨਗੇ ਸ਼ੈਦ ਸਾਡਾ ਭਾਰਤ ਇਸ ਗੱਲ 'ਤੇ ਬਹੁਤ ਤਰੱਕੀ ਕਰ ਰਿਹਾ ਹੈ ਸਾਨੂੰ ਇਸ ਗੱਲ 'ਤੇ ਮਾਣ ਹੈ ਧੰਨਵਾਦ